ਟੈਕਨੋਲੋਜੀ ਦਾ ਸਾਡੇ ਜੀਵਨ ਦੇ ਉੱਪਰ ਬਹੁਤ ਗਹਿਰਾ ਅਸਰ ਪੈ ਰਿਹਾ ਹੈ ਸਭ ਤੋਂ ਪਹਿਲਾਂ ਹਰ ਕੰਮ ਮਨੁੱਖ ਨੂੰ ਆਪ ਕਰਨਾ ਪੈਂਦਾ ਸੀ ਪਰ ਜਿਵੇਂ ਜਿਵੇਂ ਟੈਕਨੋਲੋਜੀ ਦੇ ਵਿੱਚ ਵਿਕਾਸ ਹੁੰਦਾ ਰਿਹਾ ਤਾਂ ਮਨੁੱਖ ਆਪਣੇ ਕੰਮ ਕਰਨ ਦੇ ਲਈ ਵੱਖ ਵੱਖ ਔਜਾਰ ਬਣਾਉਂਦਾ ਰਿਹਾ ਸਭ ਤੋਂ ਪਹਿਲਾ ਮਨੁੱਖ ਨੇ ਕੁਛ ਨਾ ਮਸ਼ੀਨਰੀ ਵਗੈਰਾ ਅ ਮਸ਼ੀਨਰੀ ਬਣਾਈ ਜਿਸ ਨਾਲ ਮਨੁੱਖ ਆਪਣੇ ਕੰਮ ਨੂੰ ਉਸ ਮਸ਼ੀਨਰੀ ਦੁਆਰਾ ਪੂਰਾ ਕਰ ਸਕੇ ਮਸ਼ੀਨਾਂ ਦੇ ਆਉਣ ਨਾਲ ਮਨੁੱਖ ਦੇ ਉੱਪਰ ਕੰਮ ਦਾ ਭਾਰ ਘੱਟ ਹੁੰਦਾ ਰਿਹਾ ਅਤੇ ਮਨੁੱਖ ਦਾ ਕੰਮ ਕਰਨ ਦੇ ਲਈ ਮਸ਼ੀਨਰੀ ਦੀ ਵਰਤੋਂ ਵਿੱਚ ਵਾਧਾ ਹੁੰਦਾ ਰਿਹਾ ਮਸ਼ੀਨਰੀ ਦੀ ਵਰਤੋਂ ਤੋਂ ਬਾਅਦ ਹੁਣ ਮਨੁੱਖ ਦਾ ਕੰਮ ਆਸਾਨ ਕਰਨ ਲਈ ਨਵੇਂ ਨਵੇਂ ਸਾਫਟਵੇਅਰ ਆ ਰਹੇ ਹਨ ਜੋ ਮਨੁੱਖ ਦੇ ਦਿਮਾਗ ਦਾ ਕੰਮ ਵੀ ਬਹੁਤ ਛੇਤੀ ਕਰ ਦਿੰਦੇ ਹਨ ਇਸਦੇ ਵਿੱਚ ਸਭ ਤੋਂ ਜ਼ਰੂਰੀ ਵਿਕਾਸ ਆਰਟੀਫਿਸ਼ਲ ਇੰਟੈਲੀਜੈਂਸ ਏ ਆਈ ਦਾ ਹੋਇਆ ਹੈ